ਪੰਜਾਬੀ ਭਾਸ਼ਾ ਇੱਕ ਕੌਮਾਂਤਰੀ ਭਾਸ਼ਾ ਬਣਦੀ ਜਾ ਰਹੀ ਹੈ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੋਲੀ ਜਾ ਰਹੀ ਹੈ ਪੰਜਾਬੀ ਭਾਸ਼ਾ ਬਹੁਤ ਹੀ ਸਰਲ ਤਰੀਕੇ ਨਾਲ਼ ਬੋਲਣ ਵਾਲੀ ਭਾਸ਼ਾ ਹੈ ਜੋ ਕਿ ਆਪਾਂ ਆਸਾਨ ਤਰੀਕੇ ਨਾਲ਼ ਸਿੱਖ ਵੀ ਸਕਦੇ ਹਾਂ ਅਤੇ ਬੋਲ ਵੀ ਸਕਦੇ ਹਾਂ ਇਸ ਦੀਆਂ ਬਹੁਤ ਵਿਸ਼ੇਸ਼ਤਾਵਾਂ ਹਨ ਵਿਸ਼ੇਸ਼ਤਾਵਾਂ ਇਸ ਤਰੀਕੇ ਨਾਲ਼ ਹਨ ਕਿ ਆਪਾਂ ਇੱਕ ਵਰਡ ਇੱਕ ਅੱਖਰ ਦੇ ਵਿੱਚ ਹੀ ਸਾਹਮਣੇ ਵਾਲ਼ੇ ਬੰਦੇ ਨੂੰ ਗੱਲ ਸਮਝਾ ਸਕਦੇ ਹਾਂ ਜਦ ਕਿ ਹੋਰ ਭਾਸ਼ਾਵਾਂ ਦੇ ਇੱਕ ਅੱਖਰ ਦੇ ਹੀ ਕਈ ਮਤਲਬ ਨਿਕਲਦੇ ਹਨ ਇਸ ਕਰਕੇ ਇਸ ਪੰਜਾਬੀ ਭਾਸ਼ਾ ਦਾ ਉਚਾਰਨ ਕਰਨਾ ਬਹੁਤ ਹੀ ਜ਼ਰੂਰੀ ਹੈ